ਮੈਂ ਗੁਰਦਾਸਪੁਰ ਤੋਂ ਹਰਜੀਤ ਕੌਰ ਬੋਲਦੀ ਆਂ ਸਤਿ ਸ੍ਰੀ ਅਕਾਲ ਜੀ ਅਸੀਂ ਦੋਵੇਂ ਜੀ ਬਿਜ਼ਨਸ ਕਰਦੇ ਹਾਂ ਜਿਹਦੇ ਵਿੱਚ ਇਨਕਮ ਟੈਕਸ ਭਰਨਾ ਬੜਾ ਜਰੂਰੀ ਆ ਜੋ ਅਸੀਂ ਹਰ ਮਹੀਨੇ ਸਮੇ ਸਿਰ ਭਰ ਰਹੇ ਹਾਂ ਹੁਣ ਮੇਰੇ ਬੱਚਿਆਂ ਨੂੰ ਛੁੱਟੀਆਂ ਪਈਆਂ ਨੇ ਹੁਣ ਬੱਚੇ ਬੜੀ ਜਿਦ ਕਰਦੇ ਨੇ ਅਸੀਂ ਬਾਹਰ ਘੁੰਮਣ ਜਾਣਾ ਇਸ ਕਰਕੇ ਸਾਨੂੰ ਇਨਕਮ ਟੈਕਸ ਰਿਫੰਡ ਸਲਿਪ ਦੀ ਜਰੂਰਤ ਹੈ ਸਾਨੂੰ ਪਤਾ ਹੈ ਕਿ ਇਸ ਕੰਮ ਨੂੰ ਵੀਹ ਦਿਨ ਲੱਗ ਜਾਂਦੇ ਨੇ ਪਰ ਇਹ ਨਾ ਹੋਵੇ ਕਿ ਛੁੱਟੀਆਂ ਖਤਮ ਹੋ ਜਾਣ ਸਾਨੂੰ ਕਿਰਪਾ ਕਰਕੇ ਜਲਦੀ ਤੋਂ ਜਲਦੀ ਇਨਕਮ ਟੈਕਸ ਰਿਫੰਡ ਦੀ ਰਸੀਦ ਦਿੱਤੀ ਜਾਵੇ ਤੇ ਤੁਹਾਡਾ ਬੜਾ ਧੰਨਵਾਦ ਹੋਵੇਗਾ